ਮੈਂ ਵਰਿੰਦਰ ਕੁਮਾਰ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਜਦੋਂ ਇੱਕ ਕਮੀਜ਼ ਖਰੀਦਣ ਦਾ ਮਨ ਬਣਾਇਆ ਤਾਂ ਮੇਰੇ ਬੇਟੇ ਨੇ ਮੈਨੂੰ ਦੱਸਿਆ ਕਿ ਅੱਜ ਕੱਲ੍ਹ ਔਨਲਾਈਨ ਹਰ ਤਰ੍ਹਾਂ ਦੀ ਸ਼ੋਪਿੰਗ ਕੀਤੀ ਜਾ ਸਕਦੀ ਹੈ ਮੈਂ ਵੀ ਔਨਲਾਈਨ ਸ਼ੋਪਿੰਗ ਕਰਨ ਦਾ ਮਨ ਬਣਾਇਆ ਅਤੇ ਇੱਕ ਸ਼ਰਟ ਦਾ ਆਰਡਰ ਕਰ ਦਿੱਤਾ ਕੁਝ ਦਿਨ ਬਾਅਦ ਮੈਨੂੰ ਸ਼ਰਟ ਦਾ ਪਾਰਸਲ ਪ੍ਰਾਪਤ ਹੋਇਆ ਜਦੋਂ ਮੈਂ ਉਸ ਪਾਰਸਲ ਨੂੰ ਖੋਲ੍ਹਿਆ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਨੂੰ ਸ਼ਰਟ ਦੇਖ ਕੇ ਓ ਬਹੁਤ ਚਾਅ ਚੜ ਗਿਆ ਜਦੋਂ ਮੈਂ ਉਸ ਸ਼ਰਟ ਨੂੰ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹਨਾਂ ਨੇ ਸ਼ਰਟ ਦੇਖ ਕੇ ਬੜੀ ਖੁਸ਼ੀ ਦਾ ਐ ਅਨੁਭਵ ਕੀਤਾ ਸਾਰਾ ਜਦੋਂ ਮੇਰੇ ਦੋਸਤਾਂ ਨੇ ਵੀ ਉਸ ਸ਼ਰਟ ਨੂੰ ਦੇਖਿਆ ਤਾਂ ਉਹਨਾਂ ਨੇ ਉਸ ਤਰ੍ਹਾਂ ਦੀ ਸ਼ਰਟ ਮੰਗਵਾਉਣ ਦੀ ਗੱਲ ਕੀਤੀ ਉਨਾਂ ਨੇ ਮੈਨੂੰ ਪੁੱਛਿਆ ਵੀ ਇਹ ਸ਼ਰਟ ਕਿੱਥੋਂ ਮੰਗਵਾਈ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਸ਼ਰਟ ਮੈਂ ਐਮਾਜੋਨ ਤੋਂ ਆਰਡਰ ਕੀਤੀ ਹੈ ਇਹ ਮੈਨੂੰ ਉਹਨਾਂ ਦੁਆਰਾ ਭੇਜੀ ਗਈ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸਾਂ ਕਿ ਔਨਲਾਈਨ ਚੀਜ਼ ਮੰਗਾਉਣਾ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਸਾਨੂੰ ਚੀਜ਼ ਵੀ ਚੰਗੀ ਮਿਲ ਜਾਂਦੀ ਹੈ ਜੇਕਰ ਸਾਨੂੰ ਚੀਜ਼ ਚੰਗੀ ਨਹੀਂ ਮਿਲਦੀ ਤਾਂ ਆਪਾਂ ਉਸ ਚੀਜ਼ ਨੂੰ ਵਾਪਿਸ ਕਰ ਸਕਦੇ ਹਾਂ ਠੀਕ ਹੈ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਆਪਾਂ ਉਸ ਚੀਜ਼ ਨੂੰ ਜੇ ਸਾਨੂੰ ਪਸੰਦ ਨਾ ਹੋਵੇ ਤਾਂ ਆਪਾਂ ਉਸ ਨੂੰ ਵਾਪਿਸ ਵੀ ਕਰ ਸਕਦੇ ਹਾਂ ਧੰਨਵਾਦ